ਭਾਰਤ ਦਾ ਇਤਿਹਾਸ ਬਹੁਤ ਹੀ ਡੂੰਘਾ ਹੈ ਭਾਰਤ ਵਿੱਚ ਲੋਕ ਅੱਸੀ ਹਜ਼ਾਰ ਤੋਂ ਲੈ ਕੇ ਇੱਕ ਸਾਲ ਇੱਕ ਲੱਖ ਸਾਲ ਹੋ ਗਏ ਹਨ ਕਿ ਇੱਥੇ ਲੋਕ ਰਹਿ ਰਹੇ ਹਨ ਅਸੀਂ ਜਿੱਦਾਂ ਜਾਣਦੇ ਹਾਂ ਕਿ ਭਾਰਤ ਨੇ ਸ਼ੁਰੂ ਦੇ ਵਕਤ ਵਿੱਚ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ ਸਾਡਾ ਦੇਸ਼ ਬਹੁਤ ਹੀ ਗਰੀਬ ਦੇਸ਼ ਸੀ ਅਤੇ ਇਸਦੇ ਲੇਕਿਨ ਇਸ ਦੇ ਵਿੱਚ ਬਹੁਤ ਹੀ ਸੋਹਣੇ ਸੋਹਣੇ ਗਹਿਣੇ ਸਨ ਜਿਹਨੇ ਜਿਵੇਂ ਕਿ ਸਭ ਤੋਂ ਵੱਡਾ ਸਾਡਾ ਗਹਿਣਾ ਸੀ ਕੋਹਿਨੂਰ ਅਤੇ ਇਸ ਦੀਆਂ ਫਸਲਾਂ ਅਤੇ ਹੋਰ ਵੀ ਬਹੁਤ ਕੁਝ ਸੀ ਸਰਕਾ ਬ੍ਰਿਟਿਸ਼ ਸਰਕਾਰ ਨੇ ਇਸ ਸਭ ਨੂੰ ਦੇਖਦੇ ਹੋਏ ਕਿ ਇਥੋਂ ਦੇ ਲੋਕ ਬਹੁਤ ਹੀ ਅਨਪੜ੍ਹ ਹਨ ਉਹਨਾਂ ਨੇ ਇਸ ਮੌਕੇ ਦਾ ਫ਼ਾਇਦਾ ਉਠਾਇਆ ਸੀ ਅਤੇ ਅਸਾਡੇ ਉੱਪਰ ਕਈ ਸਾਲ ਰਾਜ ਕੀਤਾ ਤਕਰੀਬਨ ਦੋ ਸੌ ਸਾਲ ਸਾਡੇ ਉੱਤੇ ਬ੍ਰਿਟਿਸ਼ ਸਰਕਾਰ ਨੇ ਰਾਜ ਕੀਤਾ ਜਿਸ ਕਾਰਣ ਸਾਡਾ ਦੇਸ਼ ਬਹੁਤ ਹੀ ਪਿੱਛੇ ਚਲ ਗਿਆ ਹੁਣ ਅਸੀਂ ਲੇਕਿਨ ਸਾਡੇ ਕਈ ਐਸੇ ਦੇਸ਼ ਭਗਤ ਸਨ ਜਿਨ੍ਹਾਂ ਨੇ ਸਾਨੂੰ ਉਹਨਾਂ ਕੋਲੋਂ ਮੁਗਲਾਂ ਅਤੇ ਬ੍ਰਿਟਿਸ਼ ਕੋਲੋਂ ਛੁਡਵਾਇਆ ਪਹਿਲਾਂ ਗੁਰੂਆਂ ਨੇ ਸਾਨੂੰ ਮੁਗਲਾਂ ਕੋਲੋਂ ਆਜ਼ਾਦੀ ਦਿੱਤੀ ਅਤੇ ਫਿਰ ਸਾਡੇ ਦੇਸ਼ ਭਗਤਾਂ ਨੇ ਸਾਨੂੰ ਬ੍ਰਿਟਿਸ਼ ਸਰਕਾਰ ਕੋਲੋਂ ਆਜ਼ਾਦ ਕਰਵਾਇਆ ਸੀ ਮੈਨੂੰ ਆਪਣੇ ਗੁਰੂਆਂ ਅਤੇ ਦੇਸ਼ ਭਗਤਾਂ 'ਤੇ ਬਹੁਤ ਮਾਣ ਹੈ ਇਹਨਾਂ ਕਰਕੇ ਅੱਜ ਅਸੀਂ ਚੰਗੀ ਜ਼ਿੰਦਗੀ ਜੀ ਰਹੇ ਹਾਂ ਅਤੇ ਇੰਨੇ ਸੋਹਣੇ ਦੇਸ਼ ਵਿੱਚ ਰਹਿ ਰਹੇ ਹਾਂ ਹੁਣ ਸਾਡਾ ਦੇਸ਼ ਕਿਸੇ ਦੇਸ਼ ਤੋਂ ਘੱਟ ਨਹੀਂ ਹੈ ਅਤੇ ਇਹ ਤਰੱਕੀਆਂ ਵੱਲ ਵੱਧ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅਸਾਡਾ ਦੇਸ਼ ਸਭ ਤੋਂ ਚੰਗਾ ਦੇਸ਼ ਅਤੇ ਤਰੱਕੀ ਵਾਲਾ ਦੇਸ਼ ਹੋਵੇਗਾ ਮੈਂ ਮੇਰੇ ਲਈ ਸਭ ਤੋਂ ਇਤਿਹਾਸਿਕ ਪਲ ਉਹ ਹੈ ਜਦੋਂ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਬਿਨਾਂ ਕੁਝ ਸੋਚੇ ਸਮਝੇ ਸਾਡੇ ਦੇਸ਼ ਲਈ ਲੜੇ ਅਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ ਸਿਰਫ਼ ਇਸ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਇਸ ਦੇਸ਼ ਦੇ ਲੋਕਾਂ ਨੂੰ ਆਜ਼ਾਦ ਕਰਵਾਉਣ ਲਈ ਕਈ ਸਾਰੇ ਹੋਰ ਵੀ ਮਿਸ ਬੇਸ ਬੇ ਮਿ ਮਿਸਾਲ ਨੇਤਾਵਾਂ ਹ ਨੇਤਾਵਾਂ ਹਨ ਜਿਨ੍ਹਾਂ ਨੇ ਆਜ਼ਾਦੀ ਵਿੱਚ ਇਹਨਾਂ ਦਾ ਸਾਥ ਦਿੱਤਾ ਜਿਵੇਂ ਕਿ ਸੁਭਾਸ਼ ਚੰਦਰ ਬੋਸ ਫਿਰ ਹੋਰ ਹੋ ਗਿਆ ਮਹਾਤਮਾ ਗਾਂਧੀ ਝਾਂਸੀ ਕੀ ਰਾਣੀ ਅਤੇ ਹੋਰ ਵੀ ਕਈ ਸਾਰੇ ਹਨ ਜਿਨ੍ਹਾਂ ਨੇ ਸਾਨੂੰ ਆਜ਼ਾਦ ਕੀਤਾ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਭਗਤ ਸਿੰਘ ਹੈ ਅਤੇ ਝਾਂਸੀ ਦੀ ਰਾਣੀ ਹੈ ਕਿਉਂਕਿ ਇਹਨਾਂ ਨੇ ਕੁਝ ਸਮ ਨਾ ਸਮਝੇ ਆਪਣੇ ਲਈ ਕੁਝ ਨਾ ਸੋਚਦੇ ਹੋਏ ਸਾਡੇ ਦੇਸ਼ ਨੂੰ ਆਜ਼ਾਦ ਕੀਤਾ ਹੈ ਧੰਨਵਾਦ